ਸਾਡੇ ਕੋਲ ਪੰਛੀ ਦੇਖਣ ਦੀਆਂ ਪਰੰਪਰਾਵਾਂ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅੰਧ ਵਿਸ਼ਵਾਸ ਨਹੀਂ ਹੈ ਪਰ ਸਾਨੂੰ ਪੰਛੀ ਦੇਖਣ ਵਿੱਚ ਬਹੁਤ ਸੁੰਦਰ ਲੱਗਦੇ ਹਨ